ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਅਮਨਦੀਪ ਕੌਰ ਬੋਲ ਰਹੀ ਹਾਂ ਹਾਂਜੀ ਹਾਂਜੀ ਸਰ ਮੈਂ ਪਜ਼ੇਰੀਆ ਤੋਂ ਬੋਲ ਰਹੇ ਹੋ ਨਾ ਤੁਸੀਂ ਹਾਂਜੀ ਸਰ ਮੈਂ ਨਾ ਇੱਕ ਪੀਜ਼ਾ ਅਤੇ ਪਾਸਤਾ ਅਤੇ ਦੋ ਸ਼ੇਕਸ ਦਾ ਔਡਰ ਦਿੱਤਾ ਸੀ ਤਾਂ ਮੈਨੂੰ ਨਾ ਪਤਾ ਨਹੀਂ ਚੱਲ ਰਿਹਾ ਕਿ ਮੇਰਾ ਔਡਰ ਕਿੱਥੋਂ ਤੱਕ ਪਹੁੰਚਿਆ ਤਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਔਡਰ ਉੱਥੋਂ ਨਿਕਲ ਗਿਆ ਕਿ ਹਜੇ ਰਸਤੇ 'ਚ ਆ ਹਾਂਜੀ ਹਾਂਜੀ ਸਰ ਐਕਚਲੀ ਮੈਨੂੰ ਅਰਜੈਂਟ ਚਾਹੀਦਾ ਸੀ ਤੁਸੀਂ ਮੈਨੂੰ ਦੱਸ ਦਿਉ ਕਿੰਨੇ ਟਾਈਮ ਤੱਕ ਆਏਗਾ ਜੇ ਅ ਟਾਈਮ ਲੱਗੇਗਾ ਤਾਂ ਵੀ ਦੱਸ ਦਿਉ ਜੇ ਨਹੀਂ ਲੱਗੇਗਾ ਤਾਂ ਵੀ ਹਾਂਜੀ ਹਾਂਜੀ ਸਰ ਪੀਜ਼ਾ ਅਤੇ ਦੋ ਸ਼ੇਕਸ ਵਿਦ ਪਾਸਤਾ ਸੀ ਹਾਂਜੀ ਹਾਂਜੀ ਸਰ ਅਸੀਂ ਰੈਗੂਲਰ ਤੁਹਾਡੇ ਤੋਂ ਹੀ ਮੰਗਵਾਉਂਦੇ ਹਾਂ ਸੋ ਇਸ ਲਈ ਅਸੀਂ ਹੁਣ ਵੀ ਤੁਹਾਡੇ ਤੋਂ ਹੀ ਔਡਰ ਕੀਤਾ ਅਤੇ ਹਾਂ ਓਕੇ ਓਕੇ ਸਰ ਵਿਦ ਇਨ ਫਿਫਟੀਨ ਮਿੰਨਟਸ ਆ ਜਾਏਗਾ ਸਰ ਓਕੇ ਓਕੇ ਹਾਂਜੀ ਸਰ ਅਤੇ ਹਾਂਜੀ ਸਰ ਉਹ ਡਿਲੀਵਰੀ ਬੋਆਏ ਨੂੰ ਨਾ ਮੇਰਾ ਐਡਰੈਸ ਸਮਝਾ ਦੇਣਾ ਚੰਗੀ ਤਰ੍ਹਾਂ ਕਿਉਂਕਿ ਮੇਰੀ ਗਲੀ ਥੋੜ੍ਹੀ ਨਾ ਟਾਈਟ ਆ ਅਤੇ ਇਹ ਨਾ ਹੋਵੇ ਉਹ ਬਾਹਰ ਹੀ ਛੱਡ ਜੇ ਅਤੇ ਮੈਂ ਬਾਹਰ ਨਹੀਂ ਆ ਸਕਦੀ ਤੇ ਉਹਨੂੰ ਕਹਿਣਾ ਅੰਦਰ ਤੱਕ ਛੱਡ ਕੇ ਜਾਵੇ ਹਾਂਜੀ ਓਕੇ ਓਕੇ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਧੰਨਵਾਦ ਧੰਨਵਾਦ